ਪੰਜਾਬ ਦੀ ਸਾਖਰਤਾ ਜੋ ਕਿ ਭਾਰਤ ਦੀ ਸਾਖਰਤਾ ਨਾਲੋਂ ਕਿਤੇ ਵੱਧ ਹੈ ਜੋ ਕਿ ਸੱਤਰ ਪ੍ਰਤੀਸ਼ਤ ਤੋਂ ਵੱਧ ਹੈ ਜੇਕਰ ਦੇਖਿਆ ਜਾਵੇ ਸਾਡੇ ਸੰਸਥਾਨ ਸਿੱਖਿਆ ਸੰਸਥਾਨ ਜੋ ਹਨ ਉਹ ਪੁਰਾਣੇ ਪੰਜਾਬ ਤੋਂ ਲੈ ਕੇ ਹੁਣ ਤੱਕ ਕਾਫੀ ਵਾਧਾ ਹੋਇਆ ਹੈ ਜਿਵੇਂ ਕਿ ਵੱਡੇ ਉੱਚ ਉੱਚ ਸੰਸਥਾਨ ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਕੇਂਦਰੀ ਯੂਨੀਵਰਸਿਟੀ ਬਠਿੰਡਾ ਨਵੀਂ ਨਵੀਆਂ ਹੋਰ ਯੂਨੀਵਰਸਿਟੀ ਜਿਹੜੀਆਂ ਉਭਰ ਕੇ ਆ ਰਹੀਆਂ ਨੇ ਸਰਕਾਰੀ ਹੋਣ ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਉਹ ਏਡਡ ਹੋਣ ਗਵਰਮੈਂਟ ਦੁਆਰਾ ਉਹਨਾਂ ਨੂੰ ਪੈਸਿਆਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਕਾਫੀ ਹੱਦ ਤੱਕ ਅਲੱਗ ਅਲੱਗ ਛੋਟੇ ਛੋਟੇ ਪਿੰਡਾਂ ਦਾ ਵੀ ਉੱਚ ਉੱਚਾ ਵਿਕਾਸ ਹੋ ਰਿਹਾ ਹੈ ਅਤੇ ਅਲੱਗ ਅਲੱਗ ਡਿਸਟਰਿਕਟ ਦਾ ਅਲੱਗ ਅਲੱਗ ਤਰੀਕੇ ਨਾਲ ਉੱਚਾ ਵਿਕਾਸ ਹੋ ਰਿਹਾ ਹੈ ਸਿੱਖਿਆ ਪੱਧਰ 'ਤੇ ਦੇ ਨਾਲ ਨਾਲ ਸਮਾਜਿਕ ਅਤੇ ਆਰਥਿਕ ਪੱਧਰ 'ਤੇ ਉਹਨਾਂ ਦੀ ਕਾਫੀ ਹੱਦ ਤੱਕ ਅ ਉੱਚ